ਹਾਂਜੀ ਬਿਲਕੁਲ ਮੀਡੀਆ ਉੱਤੇ ਕਾਫ਼ੀ ਐਸੀਆਂ ਖਬਰਾਂ ਜੋ ਨਹੀਂ ਦਿਖਾਈਆਂ ਜਾਂਦੀਆਂ ਅਤੇ ਕੁਛ ਐਸੀਆਂ ਖਬਰਾਂ ਨੇ ਜੋ ਦਿਖਾਈਆਂ ਜਾਂਦੀਆਂ ਪਰ ਉਨ੍ਹਾਂ ਦਾ ਕੋਈ ਤੱਥ ਨਹੀਂ ਹੁੰਦਾ ਜਿਵੇਂ ਕਿ ਦੇਖੋ ਆਪਣੇ ਦੇਸ਼ 'ਚ ਕਿੰਨੀ ਗਰੀਬੀ ਹੈ ਬੱਚੇ ਕਿਵੇਂ ਭੁੱਖਮਰੀ ਨਾਲ ਮਰ ਰਹੇ ਨੇ ਕਿਨ ਗਰੀਬਾਂ ਦੀ ਕੋਈ ਜੂਨ ਨਹੀਂ ਉਨ੍ਹਾਂ ਸਿਰਫ਼ ਲਾਲਚ ਦਿੱਤਾ ਜਾਂਦਾ ਤੁਹਾਨੂੰ ਆਹ ਚੀਜ਼ ਦਿੱਤੀ ਜਾਵੇਗੀ ਆਹ ਚੀਜ਼ ਦਿੱਤੀ ਜਾਵੇਗੀ ਪਰ ਉਨ੍ਹਾਂ ਨੂੰ ਵਿਚਾਰਿਆਂ ਨੂੰ ਇੱਕ ਰੋਟੀ ਤੱਕ ਨਹੀਂ ਦਿੱਤੀ ਜਾਂਦੀ ਹੋਰ ਬਹੁਤ ਕੁਛ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਸਿਰਫ਼ ਲਾਲਚ ਦਿੱਤਾ ਜਾਂਦਾ ਉਨ੍ਹਾਂ ਤੋਂ ਕੰਮ ਵੀ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਐਂ ਨਹੀਂ ਵੀ ਹੈ ਵੀ ਸਰਕਾਰਾਂ ਨੂੰ ਵੀ ਇਨ੍ਹਾਂ ਨੂੰ ਕੋਈ ਕੰਮ ਅੱਛਾ ਚੰਗਾ ਦੇ ਤਾਂ ਕਿ ਆਪਦੀ ਜ਼ਿੰਦਗੀ ਸੁਧਾਰ ਸਕਣ ਇਹ ਗਰੀਬੀ ਦੇ ਉ ਉੱਚੇ ਉੱਠ ਸਕਣ ਮੀਡੀਆ ਐਸਾ ਕੁਛ ਨਹੀਂ ਦਿਖਾਉਂਦੀ ਮੀਡੀਆ ਦਿਖਾਉਂਦੀ ਆ ਵੀ ਸਰਕਾਰ ਨੇ ਇੰਨਾਂ ਪੈਸਾ ਇੱਥੇ ਲਾ ਤਾ ਇੰਨਾਂ ਪੈਸੇ ਇੱਥੇ ਲਾ ਤਾ ਬਸ ਇਹੀ ਦਿਖਾਉਣਾ ਚਾਹੁੰਦੀ ਸਰਕਾਰ ਨੂੰ ਹੋਰ ਉਹ ਕੁਛ ਨਹੀਂ ਦਿਖਾਉਂਦੇ ਮੀਡੀਆ ਵੀ ਸਾਰੇ ਇਨ੍ਹਾਂ ਸਰਕਾਰਾਂ ਦੇ ਨਾਂ 'ਤੇ ਹੀ ਚਲਦੀ ਹੈ ਸਰਕਾਰ ਜਿਵੇਂ ਕਹਿੰਦੀ ਹੈ ਮੀਡੀਆ ਓਵੇਂ ਹੀ ਕਰਦੀ ਹੈ ਇੱਥੇ ਆਪਣੇ ਦੇਸ਼ 'ਚ ਇੰਨੀ ਗਰੀਬੀ ਹੈ ਬੱਚਿਆਂ ਨੂੰ ਪੜ੍ਹਾਇਆ ਤੱਕ ਨਹੀਂ ਜਾ ਰਿਹਾ ਬੱਚੇ ਇੰਨੇ ਗਰੀਬੀ ਦੇ ਦੌਰ 'ਚੋਂ ਗੁਜ਼ਰ ਰਹੇ ਨੇ ਉਨ੍ਹਾਂ ਨੂੰ ਪੜ੍ਹਾਉਣ ਦਾ ਕੋਈ ਹੈ ਨਹੀਂ ਵੀ ਉਨ੍ਹਾਂ ਨੂੰ ਪੜ੍ਹਾਇਆ ਲਿਖਾ ਕੇ ਅੱਗੇ ਵਧਾਇਆ ਜਾਵੇ ਅੱਜ ਕੱਲ੍ਹ ਦੇਖੋ ਸਰਕਾਰ ਕਿੰਨੀ ਮਾੜੀ ਹਾਲਤ ਇੰਨੀ ਬੁਰੀ ਹਾ ਹਾਲਤ ਕਰ ਰਹੀ ਹੈ ਸ ਟੀਚਰਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਟੀਚਰਾਂ ਨੂੰ ਵੀ ਕੁੱਟ ਮਾਰ ਕੇ ਉਨ੍ਹਾਂ ਨੂੰ ਘੜੀਸਿਆ ਜਾਂਦਾ ਗਾ ਵਾਲਾਂ ਤੋਂ ਫੜ ਕੇ ਸਰਕਾਰ ਨੂੰ ਚਾਹੀਦਾ ਕੇ ਉਨ੍ਹਾਂ ਨੂੰ ਮੋਟੀਵੇਸ਼ਨ ਕਰਨ ਵੀ ਹਾਂ ਤੁਸੀਂ ਬੱਚਿਆਂ ਨੂੰ ਪੜ੍ਹਾਓ ਅਸੀਂ ਤੁਹਾਡੇ ਨਾਲ ਹਾਂ ਉਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਮੀਡੀਆ ਨੂੰ ਸਿਰਫ਼ ਖਬਰ ਚਾਹੀਦੀ ਹੈ ਵੀ ਹਾਂ ਉੱਥੇ ਸਰਕਾਰ ਨੇ ਆਹ ਕੀਤਾ ਉਹ ਅਸੀਂ ਦਿਖਾਵਾਂਗੇ ਪਰ ਜਿਹੜਾ ਟੀਚਰਾਂ ਉੱਤੇ ਕੀਤਾ ਜਾਂਦਾ ਅੱਤਿਆਚਾਰ ਉਹ ਨਹੀਂ ਦਿਖਾਉਂਦੀ ਬਸ ਟੀਚਰਾਂ ਨੂੰ ਸਿਰਫ਼ ਇੱਕ ਪੁਤਲਾ ਬਣਾਇਆ ਰੱਖ ਰੱਖਿਆ ਵੀ ਅਸੀਂ ਇੱਧਰੋਂ ਘੁੰਮਾਉਂਦੇ ਹਾਂ ਤਾਂ ਇੱਧਰ ਨਹੀਂ ਜਾਣਾ ਸਰਕਾਰ ਨੂੰ ਚਾਹੀਦਾ ਵੀ ਸਾਰਿਆਂ ਨੂੰ ਮਿਲ ਵਰਤ ਕੇ ਇੱਕ ਨਵੀਂ ਚੰਗੀ ਸੋਚ ਬਣਾਉਣ ਤਾਂ ਕਿ ਆਪਣੇ ਦੇਸ਼ ਦਾ ਭਲਾ ਹੋ ਸਕੇ ਬੱਚਿਆਂ ਨੂੰ ਚੰਗੀ ਸ਼ਿਕਸ਼ਾ ਮਿਲ ਸਕੇ ਗਰੀਬਾਂ ਨੂੰ ਚੰਗੀ ਤਨਖ ਕੰਮ ਮਿਲ ਸਕੇ ਚੰਗਾ ਰੁਜ਼ਗਾਰ ਮਿਲ ਸਕੇ ਸਰਕਾਰ ਨੂੰ ਇੰਨਾਂ ਚਾਹੀਦਾ ਕਿ ਉਹ ਅੱਗੇ ਆਵੇ ਅਤੇ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਦੇਸ਼ ਪ੍ਰਤੀ ਕੋਈ ਕੰਮ ਕਰੇ